ਮੈਂ ਆਪਣੇ ਓਫਿਸ ਦੀ ਇੱਕ ਮੀਟਿੰਗ ਵਿੱਚ ਸਾਂ ਅਤੇ ਉਸ ਸਮੇਂ ਮੇਰੇ ਫੋਨ ਦਾ ਬੈਲੈਂਸ ਘੱਟ ਸੀ ਮੈਨੂੰ ਬਹੁਤ ਸਾਰੀਆਂ ਮਹੱਤਵਪੂਰਨ ਵਪਾਰਕ ਕਾਲਾਂ ਕਰਨੀਆਂ ਸਨ ਪ੍ਰੰਤ ਇਸ ਲਈ ਮੈਨੂੰ ਰਿਚਾਰਜ ਕਰਨ ਦੀ ਬਹੁਤ ਲੋੜ ਮਹਿਸੂਸ ਹੋਈ ਅਤੇ ਮੈਂ ਆਪਣੇ ਭਰਾ ਨੂੰ ਟੈਕਸਟ ਕੀਤਾ ਕਿ ਉਹ ਮੇਰੇ ਫੋਨ ਦੇ ਵਿੱਚ ਰਿਚਾਰਜ ਕਰਵਾ ਦੇਵੇ ਰਿਚਾਰਜ ਦੀ ਰਕਮ ਇੱਕ ਸੌ ਨੜਿਨਵੇਂ ਰੁਪਏ ਸੀ ਮੇਰੇ ਭਰਾ ਨੇ ਭੁਗਤਾਨ ਔਨਲਾਈਨ ਵਿਧੀ ਦੁਆਰਾ ਕੀਤਾ ਮੇਰਾ ਮੋਬਾਈਲ ਨੰਬਰ ਨੌਂ ਪੰਜ ਇੱਕ ਸੱਤ ਪੰਜ ਪੰਜ ਸੱਤ ਜੀਰੋ ਨੌਂ ਨੌਂ ਸੀ ਅਤੇ ਸਿਰਫ਼ ਪੰਜ ਮਿੰਟਾਂ ਵਿੱਚ ਹੀ ਮੇਰੇ ਭਰਾ ਨੇ ਔਨਲਾਈਨ ਰਿਚਾਰਜ ਕਰਵਾ ਦਿੱਤਾ ਮੇਰੇ ਨੰਬਰ 'ਤੇ ਇਸ ਨਾਲ ਮੈਂ ਫੋਨ 'ਤੇ ਗੱਲ ਕਰ ਪਾਈ ਅਤੇ ਮੇਰਾ ਕੰਮ ਸੁਖਾਲਾ ਹੋ ਗਿਆ